ਹੈਲੋ ਮੀਸ਼ੋ ਮੈਂ ਆਮ ਤੌਰ 'ਤੇ ਇੱਥੋਂ ਹੀ ਸਾਰੇ ਆਪਦੇ ਪ੍ਰੋਡਕਟ ਲੈਂਦੀ ਹਾਂ ਜਿਵੇਂ ਮੈਂ ਬਹੁਤ ਸਾਰੀਆਂ ਸ਼ਰਟਸ ਵਗੈਰਾ ਵੀ ਉੱਥੋਂ ਹੀ ਬਾਏ ਕਰਦੀ ਹਾਂ ਹਮੇਸ਼ਾ ਬੱਟ ਇਸ ਵਾਰ ਮੈਂ ਸ਼ੂਜ਼ ਬਾਏ ਕੀਤੇ ਸੀਗੇ ਜਿਨ੍ਹਾਂ ਦੀ ਪੈਕੇਜਿੰਗ ਬਹੁਤ ਖਰਾਬ ਆਈ ਹੈ ਮੇਰੇ ਕੋਲ ਅਤੇ ਮੈਂ ਬਿਲਕੁਲ ਸੈਟਿਸਫਾ ਬਿਲਕੁਲ ਸੈਟਿਸਫਾਈ ਨਹੀਂ ਹੈਗੀ ਪ੍ਰੋਡਕਟ ਨਾਲ ਕਿਉਂਕਿ ਜਦੋਂ ਪਹਿਲੀ ਗੱਲ ਤਾਂ ਇਹ ਸੀ ਕਿ ਇਹ ਜਿਹੜੀ ਮੈਂ ਤਰੀਕ ਨੂੰ ਮੰਗਾਏ ਸੀਗੇ ਕਿ ਉਹਦੇ ਤੋਂ ਬਹੁਤ ਲੇਟ ਆਏ ਸੀਗੇ ਅਤੇ ਜਦੋਂ ਡਲਿਵਰੀ ਬੋਆਏ ਹੈਨਾ ਇਨ੍ਹਾਂ ਨੂੰ ਛੱਡਣ ਆਇਆ ਤਾਂ ਉਹਨੇ ਮਤਲਬ ਮੇਰੇ ਨਾਲ ਬਹੁਤ ਬੁਰਾ ਵਿਵਹਾਰ ਕੀਤਾ ਜਿਹਦੇ ਕਰਕੇ ਕਿ ਮੈਨੂੰ ਬਹੁਤ ਬੁਰਾ ਲੱਗਿਆ ਅਤੇ ਜਦੋਂ ਮੈਂ ਇਹਨਾਂ ਨੂੰ ਖੋਲ੍ਹਿਆ ਅਤੇ ਇਨ੍ਹਾਂ ਦੀ ਪੈਕੇਜਿੰਗ ਵੀ ਬਹੁਤ ਖਰਾਬ ਸੀ ਬਿਲਕੁਲ ਸਹੀ ਢੰਗ ਢੰਗ ਨਾਲ ਇਨ੍ਹਾਂ ਦੀ ਪੈਕੇਜਿੰਗ ਨਹੀਂ ਹੋਈ ਹੋਈ ਸੀ ਜਿਹਦੇ ਕਰਕੇ ਮੈਨੂੰ ਹੋਰ ਵੀ ਜ਼ਿਆਦਾ ਬੁਰਾ ਲੱਗਿਆ ਅਤੇ ਜਦੋਂ ਮੈਂ ਇਨ੍ਹਾਂ ਨੂੰ ਓਪਨ ਕੀਤਾ ਤਾਂ ਇਹਨਾਂ ਦਾ ਕਲਰ ਵੀ ਕੁਝ ਹੋਰ ਸੀ ਮੈਂ ਕਾਲਾ ਕਲਰ ਮੰਗਵਾਇਆ ਸੀ ਲੈਦਰ ਦੇ ਸ਼ੂਜ਼ ਸੀਗੇ ਅਤੇ ਉਨ੍ਹਾਂ ਨੇ ਚਿੱਟਾ ਕਲ ਰੰਗ ਭੇਜਿਆ ਜਦੋਂ ਮੈਂ ਇਨ੍ਹਾਂ ਨੂੰ ਪਾ ਕੇ ਦੇਖਿਆ ਤਾਂ ਉਨ੍ਹਾਂ ਦਾ ਸਾਈਜ਼ ਬਹੁਤ ਛੋਟਾ ਸੀ ਜਿਹਦੇ ਕਰਕੇ ਮੈਨੂੰ ਇਹ ਆਪਣੀ ਭੈਣ ਨੂੰ ਦੇਣੇ ਪਏ ਅਤੇ ਮੈਂ ਚਾਹੁੰਦੀ ਹਾਂ ਕਿ ਇਹ ਮੇਰੇ ਵਾਪਿਸ ਹੋ ਜਾਣ ਪਲੀਜ਼ ਇਹ ਸ਼ੂਜ਼ ਮੈਥੋਂ ਲੈ ਜਾਓ ਜਾਂ ਮੈਨੂੰ ਮੇਰੇ ਪੈਸੇ ਵਾਪਿਸ ਕਰੋ ਧੰਨਵਾਦ ਜੀ